ਹੈਲੋ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਹਰੇਕ ਬੁੱਕ 'ਤੇ ਅਲੱਗ ਅਲੱਗ ਹੁੰਦਾ ਆ ਜਿੱਦਾਂ ਜਿਹੜੀ ਪੰਜਾਬ ਬੋਰਡ ਦੀਆਂ ਆ ਜਿਹੜੇ ਪੰਜਾਬੀ 'ਚ ਆ ਉਹਨਾਂ 'ਤੇ ਦਸ ਪਰਸੈਂਟ ਡਿਸਕਾਊਂਟ ਹੁੰਦਾ ਆ ਅਤੇ ਜਿੱਦਾਂ ਇੰਗ ਇੰਗਲਿਸ਼ ਮੀਡੀਅਮ 'ਤੇ ਉਤੇ ਅੱਠ ਪਰਸੈਂਟ ਡਿਸਕਾਊਂਟ ਹੁੰਦਾ ਆ ਹਾਂਜੀ ਮਿਲ ਜਾਣਗੀਆਂ ਪਰ ਜਿਹੜੀ ਇੰਗਲਿਸ਼ ਮੀਡੀਅਮ ਵਾਲੀ ਉਹ ਉਹ ਸਾਨੂੰ ਮੰਗਵਾ ਕੇ ਦੇਣੀ ਪੈਣੀ ਹੈ ਇਸ ਵੇਲੇ ਤਾਂ ਸਾਡੇ ਕੋਲ ਮੌਜੂਦ ਨਹੀਂ ਹੈਗੀ ਅਤੇ ਬਾਕੀ ਮੈਂ ਦੂਜੀ ਚੈੱਕ ਕਰ ਲੈਂਦਾ ਜੇ ਉਹ ਮਿਲ ਗਈ ਤਾਂ ਹਿੰਦੀ ਦੀ ਹਾਂਜੀ ਹਿੰਦੀ ਦੀ ਤਾਂ ਹੈਗੀ ਆ ਪੰਜਾਬੀ ਦੀ ਵੀ ਹੈਗੀ ਆ ਇਹ ਵਾਲੀ ਨਹੀਂ ਇੰਗਲਿਸ਼ ਮੀਡੀਅਮ ਵਾਲੀ ਨਹੀਂ ਹੈਗੀ ਉਹ ਸਾਨੂੰ ਮੰਗਵਾ ਕੇ ਦੇਣੀ ਪੈਣੀ ਹਾਂਜੀ ਮੈਂ ਤੁਹਾਨੂੰ ਉਹਦਾ ਰੇਟ ਦੱਸ ਦਿੰਨਾ ਆ ਜਿਹੜੀ ਕੰਟੈਂਪਰੇਰੀ ਦੀ ਤੁਸੀਂ ਕਹਿੰਦੇ ਸੀਗੇ ਉਹ ਪੰਜ ਸੌ ਰੁਪਏ ਦੀ ਆ ਅਤੇ ਉਹਦਾ ਉਹ ਦਸ ਪਰਸੈਂਟ ਡਿਸਕਾਊਂਟ ਮਿਲਣਾ ਉਹ ਤੁਹਾਨੂੰ ਇੱਕ ਇੱਕ ਬੁੱਕ ਜਿਹੜੀ ਉਹ ਚਾਰ ਸੌ ਰੁਪਏ ਦੀ ਲੱਗ ਜਾਣੀ ਆ ਹਾਂਜੀ ਤੁਸੀਂ ਆਪਣਾ ਐਡਰੈਸ ਵਗੈਰਾ ਹਾਂਜੀ ਤੁਸੀਂ ਆਪਣਾ ਐਡਰੈਸ ਨੋਟ ਕਰਾ ਦਿਓ ਮੈਂ ਤੁਹਾਡਾ ਔਰਡਰ ਨੋਟ ਕਰਕੇ ਤੁਹਾਨੂੰ ਮੈਂ ਪੋਸਟ ਕਰ ਦੂਂਗਾ

ਠੀਕ ਏ ਪੇਮੈਂਟ ਤੁਸੀਂ ਕੈਸ਼ ਕਰੋਂਗੇ ਕੇ ਕਰਨੀ ਆ ਔਨਲਾਈਨ ਕਰਨੀ ਆ ਅੱਛਾ ਜੀ ਚਲੋ ਠੀਕ ਆ ਕੋਈ ਗੱਲ ਨਹੀਂ ਇਹ ਹੋਰ ਕੋਈ ਬੁਕਸ ਵਗੈਰਾ ਚਾਹੀਦੀਆਂ ਹੋਊਗੀਆਂ ਸਾਨੂੰ ਨੰਬਰ 'ਤੇ ਸੰਪਰਕ ਕਰ ਲਿਆ ਕਰੋ ਇਸ ਨੰਬਰ 'ਤੇ ਕਰ ਲਿਆ ਕਰੋ ਕੋਲ ਠੀਕ ਹੈ ਠੀਕ ਹੈ ਓਕੇ